ਸਤਿ ਸ਼੍ਰੀ ਅਕਾਲ ਜੀ ਮੈਂ ਕਾਰ ਬੁੱਕ ਕਰਵਾਉਣਾ ਚਾਹੁੰਦੀ ਹਾਂ ਜੋ ਕਿ ਮੈਂ ਪਿਛਲੀ ਵਾਰ ਕਰਵਾਈ ਸੀ ਅਸਲ ਵਿੱਚ ਉਹ ਡਰਾਈਵਰ ਦੀ ਡਰਾਈਵਰੀ ਬਹੁਤ ਵਧੀਆ ਸੀ ਕਾਰ ਦਾ ਸਫ਼ਰ ਬਹੁਤ ਹੀ ਆਰਾਮਦਾਇਕ ਸੀ ਅਤੇ ਡਰਾਈਵਰ ਨੇ ਮੈਨੂੰ ਸਮੇਂ ਤੋਂ ਪਹਿਲਾਂ ਹੀ ਮੇਰੀ ਮੰਜ਼ਿਲ 'ਤੇ ਪਹੁੰਚਾ ਦਿੱਤਾ ਸੀ ਮੈਨੂੰ ਰਸਤੇ ਵਿੱਚ ਕੋਈ ਪਰੇਸ਼ਾਨੀ ਨਹੀਂ ਆਈ ਇਸ ਲਈ ਕਿਰਪਾ ਕਰਕੇ ਮੈਨੂੰ ਉਹ ਹੀ ਡਰਾਈਵਰ ਅਤੇ ਗੱਡੀ ਦੁਬਾਰਾ ਭੇਜੀ ਜਾਵੇ ਧੰਨਵਾਦ